ਅਸੀਂ ਮੁਰਗੀਆਂ ਨੂੰ ਸਾਰਾ ਸਮਾਂ ਸ਼ੈਡ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਸ਼ੈਡ ਵਿੱਚ ਰੱਖਣ ਨਾਲ ਉਹਨਾਂ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ ਇਸ ਕਰਕੇ ਅਸੀਂ ਬਾਹਰ ਖੁੱਲ੍ਹੇ ਵਾਤਾਵਰਨ ਦੇ ਵਿੱਚ ਉਹਨਾਂ ਨੂੰ ਤੁਰਨ ਫਿਰਨ ਵਾਸਤੇ ਛੱਡਦੇ ਹਾਂ ਤੁਰ ਫਿਰ ਕੇ ਉਹ ਖਾਣਾ ਖਾ ਲੈਂਦੀਆਂ ਹਨ ਪਾਣੀ ਵੀ ਪੀ ਲੈਂਦੀਆਂ ਹਨ ਇਸ ਕਰਕੇ ਆਪਣੀ ਮਨਪਸੰਦ ਦਾ ਖਾਣਾ ਚੋਗਾ ਚੁੱਗ ਕੇ ਢਿੱਡ ਭਰ ਆਪਣਾ ਪੇਟ ਭਰ ਲੈਂਦੀਆਂ ਹਨ ਫਿਰ ਖੁੱਲ੍ਹੇ ਵਾਤਾਵਰਨ ਦੇ ਵਿੱਚ ਉਹਨਾਂ ਨੂੰ ਤ੍ਰਿਪਤੀ ਮਿਲਦੀ ਹੈ ਰਲ ਮਿਲ ਕੇ ਆਪਣਾ ਮਨਪਸੰਦ ਦਾ ਮਨੋਰੰਜਨ ਕਰ ਲੈਂਦੀਆਂ ਹਨ ਫਿਰ ਅਸੀਂ ਸ਼ਾਮ ਦੇ ਟਾਈਮ ਉਹਨਾਂ ਨੂੰ ਸ਼ੈਡ ਵਿੱਚ ਬੰਦ ਕਰ ਦਿੰਦੇ ਹਾਂ ਇਸ ਤਰ੍ਹਾਂ ਉਹਨਾਂ ਨੂੰ ਅਸੀਂ ਗੁਣਵੱਤਾ ਪ੍ਰਾਪਤ ਕਰਦੇ ਹਾਂ